ਹਾਂਜੀ ਵਧੀਆ ਮੈਮ ਤੁਸੀਂ ਦੱਸੋ ਤੁਸੀਂ ਕੌਣ ਅੱਛਾ ਕਿਸ ਕੋਈ ਕੰਪਨੀ ਜੋਬ ਕਰਦੇ ਹੋ ਤੁਸੀਂ ਅੱਛਾ ਵਧੀਆ ਕੰਪਨੀ ਆ ਵਧੀਆ ਚੀਜ਼ ਆ ਕਾਫੀ ਵੈੱਬ ਡਿਜਾਇਨਿੰਗ ਅੱਛਾ ਫਿਰ ਮੈਂ ਕੋਈ ਮਦਦ ਕਰ ਸਕਦਾ ਤੁਹਾਡੀ ਹਾਂਜੀ ਦੱਸ ਦਿੰਦਾ ਜੇ ਤੁਸੀਂ ਕੋਈ ਘਰ ਦਾ ਸਮਾਨ ਲੈਣਾ ਰਾਸ਼ਨ ਰੁਸ਼ਨ ਉੱਧਰ ਉਹ ਤੁਹਾਨੂੰ ਓਮੈਕਸ ਮੌਲ ਵਗੈਰਾ 'ਚ ਮਿਲ ਜਾਣਗੇ ਅਤੇ ਡਿਮਾਟਸ 'ਚ ਮਿਲ ਜਾਣਗੀਆਂ ਹਾਂਜੀ ਇੱਧਰ ਲੋਕਲ ਵੀ ਕਾਫੀਆਂ ਦੁਕਾਨਾਂ ਮਿਲ ਜਾਣਗੀਆਂ ਤੁਹਾਨੂੰ ਜਿੱਧਰੋਂ ਤੁਸੀਂ ਘਰ ਦਾ ਸਮਾਨ ਲੈ ਸਕਦੇ ਹੋ ਅਤੇ ਉੱਧਰ ਅਤੇ ਇੱਧਰ ਹੋਲਸੇਲ ਵੀ ਮਿਲ ਜਾਂਦਾ ਹੈ ਜੇ ਤੁਸੀਂ ਵਧੀਆ ਕੱਪੜੇ ਲੈਣੇ ਨੇ ਤਾਂ ਤੁਹਾਨੂੰ ਉਹ ਓਮੈਕਸ ਮੌਲ ਹੀ ਹੈ ਸਟੋਰ ਨਾਈਨਟੀ ਨਾਈਨ ਤੋਂ ਮਿਲ ਜਾਣਗੀਆਂ ਅੱਛਾ ਉਹ ਤੁਹਾਨੂੰ ਦੇ ਦੇਖਣਾ ਪਵੇਗਾ ਅਤੇ ਜੇ ਤੁਹਾਨੂੰ ਕੱਪੜੇ ਥੋੜ੍ਹੇ ਵਧੀਆ ਨਹੀਂ ਚਾਹੀਦੇ ਤਾਂ ਥੋੜ੍ਹੇ ਸਸਤੇ ਰੇਟ 'ਚ ਚਾਹੀਦੇ ਹਨ ਤਾਂ ਤੁਹਾਨੂੰ ਉਹ ਸ਼ਹਿਰ ਤੋਂ ਮਿਲ ਜਾਣਗੇ ਜਾਂ ਕਿਲਾ ਚੌਂਕ ਵੱਲ ਨੂੰ ਮਿਲ ਜਾਣਗੇ ਹਾਂਜੀ ਜੇ ਤੁਸੀਂ ਰੈਸਟੋਰੈਂਟ 'ਚ ਜਾਣਾ ਹੋਵੇ ਤਾਂ ਉਹ ਵੀ ਤੁਸੀਂ ਜਾ ਸਕਦੇ ਹੋ ਜੋ ਕਿ ਬਾਈਨ ਬਾਈ ਨੰਬਰ ਜੋ ਤੁਹਾਨੂੰ ਬਾਈ ਨੰਬਰ 'ਚ ਮਿਲ ਜਾਵੇਗਾ ਤੁਸੀਂ ਉੱਧਰ ਕਾਫੀ ਵਧੀਆ ਤਰੀਕੇ ਦੇ ਰੈਸਟੋਰੈਂਟ ਹਨ ਤੁਸੀਂ ਉੱਧਰ ਜਾ ਸਕਦੇ ਹੋ ਬੱਸ 'ਤੇ ਅਤੇ ਬਾਕੀ ਮੈਂ ਤੁਹਾਨੂੰ ਜਾਣਕਾਰੀ ਦੇ ਹੀ ਦਿੱਤੀ ਹੈ ਬਾਕੀ ਤੁਸੀਂ ਸ਼ਿਫਟ ਕਿੱਥੇ ਹੋਏ ਹੋ ਥੈਂਕ ਯੂ ਥੈਂਕ ਯੂ ਕੋਈ ਨਹੀਂ